ਸਾਡੇ ਸ਼ ਦੇਸ਼ ਵਿੱਚ ਬਹੁਤ ਹੀ ਸਰਕਾਰੀ ਸਕੀਮਾਂ ਤਾਂ ਬਹੁਤ ਹੈ ਸਰਕਾਰ ਵੀ ਉਹਨਾਂ ਦੀ ਬਹੁਤ ਪਹਿਲ ਕਦਮੀ ਕਰਦੀ ਹੈ ਜਿੱਦਾਂ ਕਿ ਕੋਈ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦਾ ਹੈ ਉਹਨਾਂ ਦਾ ਈ ਐੱਸ ਆਈ ਕਾਰਡ ਬਣੇ ਹਨ ਜਾਂ ਕਈਆਂ ਦੇ ਬੀਮਾ ਯੋਗ ਯੋਜਨਾ ਯੋਗ ਵਿੱਚ ਵੀ ਸਰਕਾਰ ਦੁਆਰਾ ਪੰਜ ਲੱਖ ਤੱਕ ਬੀਮਾ ਕੀਤਾ ਗਿਆ ਹੈ ਤਾਂ ਕਿ ਜੋ ਲੋਕਾਂ ਨੂੰ ਬਿਨਾਂ ਕਿਸੇ ਪੈਸੇ ਤੋਂ ਜੋ ਇਹਨਾਂ ਨੂੰ ਸਿਹਤ ਸੰਭਾਲ ਲਈ ਦਵਾਈਆਂ ਉਪਲਬਧ ਕਰਵਾਈਆਂ ਜਾ ਸਕਣ ਅਤੇ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਫਰੀ ਕੀਤਾ ਜਾਵੇ ਤਾਂ ਕਿ ਜੋ ਲੋਕ ਹੈ ਉਹ ਆਪਣੇ ਜਿਹੜੇ ਲੋਕ ਪੈਸੇ ਨਹੀਂ ਖਰਚ ਸਕਦੇ ਉਹ ਜਿਹੜੇ ਹੈ ਵੀ ਇਹਨਾਂ ਦੁਆਰਾ ਆਪਣਾ ਇਲਾਜ ਕਰਵਾ ਸਕਣ ਤਾਂ ਕਿ ਜੋ ਹੈ ਆਪਣੀ ਸਿਹਤ ਦਾ ਸੰਭਾਲ ਕਰ ਸਕਣ ਅਤੇ ਕੁਛ ਸਰਕਾਰ ਨੇ ਜੋ ਸਫਾਈ ਅਭਿਆਨ ਸ਼ੁਰੂ ਕੀਤਾ ਹੈ ਉਹ ਵੀ ਇੱਕ ਬਹੁਤ ਜੋ ਹੈ ਵਧੀਆ ਕੰਮ ਹੈ ਕਿਉਂਕਿ ਬਿਮਾਰੀ ਜੋ ਜ਼ਿਆਦਾਤਰ ਫੈਲਦੀ ਹੈ ਉਹ ਗੰਦਗੀ ਕਰਕੇ ਹੀ ਫੈਲਦੀ ਹੈ ਇਸ ਕਰਕੇ ਸਰਕਾਰ ਜੋ ਹੈ ਇਹਨਾਂ ਦੁਆਰਾ ਬਹੁਤ ਹੀ ਪਹਿਲ ਕਦਮੀ ਕਰ ਰਹੀ ਹੈ